ਸਕੂਲ ਵਿੱਚ ਮੇਰਾ ਸਭ ਤੋਂ ਮਨਪਸੰਦ ਵਿਸ਼ਾ ਪੰਜਾਬੀ ਸੀ ਕਿਉਂਕਿ ਪੰਜਾਬੀ ਮੈਨੂੰ ਸ਼ੁਰੂ ਤੋਂ ਹੀ ਪੰਜਾਬੀ ਅੱਛੀ ਲੱਗਦੀ ਸੀਗੀ ਸਾਡੇ ਸਕੂਲ ਵਿੱਚ ਵੀ ਪੰਜਾਬੀ ਦੇ ਉੱਤੇ ਜ਼ੋਰ ਦਿੱਤਾ ਜਾ ਜਾਂਦਾ ਸੀਗਾ ਸਾਡੇ ਘਰ ਵਿੱਚ ਵੀ ਪੰਜਾਬੀ ਮਾਂ ਬੋਲੀ ਬੋਲੀ ਜਾਂਦੀ ਹੈ ਪੰਜਾਬ ਦੇ ਵਿੱਚ ਪੰਜਾਬੀ ਮਾਂ ਬੋਲੀ ਲਾਜ਼ਮੀ ਹੈ ਅੱਜ ਕੱਲ੍ਹ ਤਾਂ ਪੰਜਾਬੀ ਪੰਜਾਬ ਵਿੱਚ ਬਹੁਤ ਹੀ ਜ਼ਿਆਦਾ ਜ਼ਰੂਰੀ ਹੋ ਗਈ ਹੈ ਹੁਣ ਦੇਖਿਆ ਜਾਵੇ ਤਾਂ ਸਾਡੇ ਪੰਜਾਬ ਪੁਲਿਸ ਦੀ ਭਰਤੀ ਦੇ ਲਈ ਵੀ ਹੁਣ ਪੰਜਾਬੀ ਦਾ ਪੇਪਰ ਸਪੈਸ਼ਲ ਇਹਨਾਂ ਨੇ ਅਲੱਗ ਰੱਖਿਆ ਏ ਪੇਪਰ ਦੇਣ ਤੋਂ ਬਾਅਦ ਇੱਕ ਪੇਪਰ ਰੱਖਿਆ ਏ ਪੰਜਾਬੀ ਦਾ ਜਿਹੜਾ ਬੱਚਾ ਉਸ ਵਿੱਚ ਕਲੀਅਰ ਹੁੰਦਾ ਹੈ ਉਸਨੂੰ ਹੀ ਭਰਤੀ ਕੀਤਾ ਜਾਂਦਾ ਹੈ ਇਸ ਲਈ ਪੰਜਾਬੀ ਮਾਂ ਬੋਲੀ ਦਾ ਆਉਣਾ ਬਹੁਤ ਜ਼ਰੂਰੀ ਹੈ ਹੁਣ ਹੁਣ ਮਤਲਬ ਕਿ ਪੰਜਾਬੀ ਦੇ ਵਿੱਚ ਪੰਜਾਬ ਵਿੱਚ ਹਰ ਕੁਝ ਪੰਜਾਬੀ ਦੇ ਵਿੱਚ ਹੀ ਹੋ ਰਿਹਾ ਏ ਭਾਵੇਂ ਬਾਹਰ ਯੂ ਪੀ ਵਗੈਰਾ ਦੇ ਵਿੱਚ ਪੰਜਾਬੀ ਅੱਜ ਕੱਲ੍ਹ ਨਹੀਂ ਪੜ੍ਹਾਈ ਜਾ ਰਹੀ ਪਰ ਪੰਜਾਬ ਦੇ ਵਿੱਚ ਇਸਨੂੰ ਜੋਰਾਂ ਸ਼ੋਰਾਂ 'ਤੇ ਪੜ੍ਹਾਇਆ ਜਾ ਰਿਹਾ ਏ ਮੈਨੂੰ ਪੰਜਾਬੀ ਬਹੁਤ ਅੱਛੀ ਲੱਗਦੀ ਹੈ ਮਤਲਬ ਕਿ ਮੇਰਾ ਸਭ ਤੋਂ ਪ ਮਨਪਸੰਦ ਵਿਸ਼ਾ ਪੰਜਾਬੀ ਹੈ ਇਸ ਵਿੱਚ ਮੈਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਆਉਂਦੀ ਇਸ ਕਰਕੇ ਮੈਂ ਚਾਹੁੰਦੀ ਹਾਂ ਕਿ ਆਪਣਾ ਆਉਣ ਵਾਲਾ ਜੋ ਵੀ ਮੈਂ ਆਪਣੀ ਕੋਲਜ ਦੀ ਪੜ੍ਹਾਈ ਕਰਾਂ ਅਗਲੀ ਉਚੇਰੀ ਪੜ੍ਹਾਈ ਕਰਾਂ ਪੰਜਾਬੀ ਦੇ ਵਿੱਚ ਹੀ ਕਰਾਂ